ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਸਰ ਮੈਨੂੰ ਨਾ ਤੁਹਾਡਾ ਰੈਫਰੈਂਸ ਮੇਰੇ ਦੋਸਤ ਕੋਲੋਂ ਮਿਲਿਆ ਮੈਂ ਨਾ ਐਕਚੁਲੀ ਮੈਂ ਨਾ ਫੁੱਟਵੇਅਰ ਲੱਭ ਰਿਹਾ ਸੀ ਕੋਈ ਆਪਣੇ ਵਾਸਤੇ ਅਤੇ ਮੈਨੂੰ ਨਾ ਥੋੜ੍ਹੇ ਜਿਹੇ ਮਤਲਬ ਸਲਾਹ ਦਿਓ ਜਿੱਦਾਂ ਬ੍ਰੈਂਡ ਵਗੈਰਾ ਕੀ ਤੁਹਾਡੇ ਕੋਲ ਕਿਹੜੇ ਬ੍ਰੈਂਡ ਅਵੇਲੇਬਲ ਨੇ

ਅਤੇ ਜਿੱਦਾਂ ਮਤਲਬ ਨਾਇਕੀ ਦਾ ਬਜਟ ਵਗੈਰਾ ਕੀ ਹੋਵੇਗਾ ਅੱਛਾ ਅੱਛਾ ਅਤੇ ਜਿੱਦਾਂ ਮਤਲਬ ਕਿ ਕੋਈ ਡਿਸਕਾਊਟ ਵਗੈਰਾ ਸਰ ਅੱਛਾ ਅੱਛਾ ਠੀਕ ਹੈ ਅਤੇ ਸਰ ਬਾਕੀ ਜੇ ਡਿਲੀਵਰੀ ਵਗੈਰਾ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਸਰ ਓਕੇ ਸਰ ਬਾਏ ਸਰ